ਹਾਂਜੀ ਮੈਮ ਇਮੀਗਰੇਸ਼ਨ ਤੋਂ ਬੋਲ਼ ਰਹੇ ਹੋ ਅੱਛਾ ਮੈਮ ਓਹ ਮੈਂ ਐਕਚੁਅਲੀ ਪੁੱਛਣਾ ਸੀਗਾ ਵੀ ਮੈਂ ਨਾ ਐਕਚੁਅਲੀ ਕੈਨੇਡਾ ਜਾਣਾ ਏ ਅਤੇ ਉਹਦੇ ਵਾਸਤੇ ਮੈਨੂੰ ਕਿਆ ਕੁਛ ਕਰਨਾ ਪਏਗਾ ਅਤੇ ਕਿੰਨੇ ਬੈਂਡਜ਼ ਵਗੈਰਾ ਚਾਹੀਦੇ ਆ ਮੈਮ ਹਲੇ ਮੈਂ ਪਲੱਸ ਟੂ ਕਰਕੇ ਹਟਿਆ ਏ ਜਸਟ ਪ੍ਰਸੈਂਟ ਮੇਰੇ ਮੈਮ ਏਟੀ ਫੋਰ ਪ੍ਰਸੈਂਟ ਆਏ ਹੈ ਹਾਂਜੀ

ਅੱਛਾ ਜੀ ਹਰੇਕ ਮੋਡਿਊਲ 'ਚ ਸਿਕਸ ਲੈਣੇ ਪੈਣੇ ਠੀਕ ਹੈ ਵੈਸੇ ਸਿਕਸ ਪੁਆਇੰਟ ਫਾਈਵ ਚਾਹੀਦੇ ਹੈ ਨਾ ਅਤੇ ਇਹਦਾ ਕਿਆ ਕਿਆ ਪ੍ਰੋਸੀਜ਼ਰ ਹੈ ਮੈਮ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਅਤੇ ਇਹਦੇ 'ਚ ਟਾਈਮ ਕਿੰਨਾਂ ਕੁ ਲੱਗੇਗਾ ਮੈਮ ਅੱਛਾ ਮਤਲਬ ਆਪਣੇ ਉੱਪਰ ਡਿਪੈਂਡ ਹੈ ਚਲੋ ਬਾਕੀ ਦਾ ਪਰੂਫ ਵਗੈਰਾ ਕਿਆ ਮਤਲਬ ਕਿਆ ਚਾਹੀਦਾ ਸਟਾਰਟਿੰਗ ਜੁਆਇਨਿੰਗ ਵਗੈਰਾ ਵਾਸਤੇ ਅੱਛਾ ਜੀ ਚੱਲੋ ਠੀਕ ਹੈ ਫਿਰ ਮੈ ਤੁਹਾਨੂੰ ਉਹ ਉੱਥੋਂ ਦੇ ਔਫਿਸ ਵੀਜ਼ਿਟ ਕਰਕੇ ਤੁਹਾਨੂੰ ਦੱਸੂੰਗਾ ਠੀਕ ਹੈ ਮੈਮ ਥੈਂਕ ਯੂ ਜੀ